ਜਿਵੇਂ ਕੀ ਸਾਨੂੰ ਆਮ ਤੌਰ 'ਤੇ ਹੀ ਪਤਾ ਹੈ ਕਿ ਸਾਫ਼ ਸਫ਼ਾਈ ਰੱਖਣਾ ਸਾਡੀ ਜ਼ਿੰਦਗੀ ਲਈ ਕਿੰਨੀ ਮਹੱਤਤਾ ਰੱਖਦਾ ਹੈ ਅਤੇ ਕਿੰਨੀ ਬਿਮਾਰੀਆਂ ਨੂੰ ਦੂਰ ਕਰਦਾ ਹੈ ਜਿਹੜੇ ਅਸੀਂ ਇਲਾਕੇ ਵਿੱਚ ਰਹਿੰਦੇ ਹਾਂ ਉਸ ਇਲਾਕੇ ਨੂੰ ਸਾਫ਼ ਰੱਖਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੀ ਹੋ ਜਾਂਦੀ ਹੈ ਜਾਂ ਕਹਿ ਲਓ ਅਸੀਂ ਆਪਣੇ ਆਪ ਇਲਾਕੇ ਨੂੰ ਸਾਫ਼ ਰੱਖਣ ਦੇ ਲਈ ਆਪਣੀ ਇੱਕ ਜ਼ਿੰਮੇਵਾਰੀ ਆ ਜ਼ਿੰਮੇਵਾਰ ਨਾਗਰਿਕ ਬਣੀਏ ਤਾਂ ਕਿ ਅਸੀਂ ਜਿਹੜਾ ਆਪਣਾ ਇਲਾਕਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਬੇਸ਼ੱਕ ਉਹ ਇਲਾਕਾ ਪਿੰਡ ਵਿੱਚ ਹੋਵੇ ਸ਼ਹਿਰ ਵਿੱਚ ਹੋਵੇ ਜਾਂ ਕੋਈ ਵੀ ਹੋਵੇ ਕਿਸੇ ਵੀ ਇਲਾਕੇ ਵਿੱਚ ਜਿੱਥੇ ਅਸੀਂ ਆਪਣੀ ਜੀਵਨਸ਼ੈਲੀ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਉਹਨੂੰ ਆਪਾਂ ਨੂੰ ਸਾਫ਼ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਿਸ ਇਲਾਕੇ ਵਿੱਚ ਰਹਿੰਦੀ ਹਾਂ ਮੇਨ ਤੌਰ 'ਤੇ ਉਹ ਇੱਕ ਸ਼ਹਿਰ ਹੈ ਸਾਨੂੰ ਸਭ ਨੂੰ ਪਤਾ ਹੈ ਕਿ ਸ਼ਹਿਰ ਵਿੱਚ ਤਾਂ ਗੰਦਗੀ ਹੁੰਦੀ ਹੀ ਹੈ ਕਿਉਂਕਿ ਉੱਥੇ ਦਿਨ ਰਾਤ ਵਾਹਨ ਚੱਲਦੇ ਰਹਿੰਦੇ ਹਨ ਦਿਨ ਰਾਤ ਉੱਥੇ ਪ੍ਰਦੂਸ਼ਣ ਹੁੰਦਾ ਹੈ ਵਾਹਨ ਚੱਲਣ ਨਾਲ਼ ਪ੍ਰਦੂਸ਼ਣ ਵੀ ਹੁੰਦਾ ਹੈ ਅਤੇ ਉੱਥੇ ਦਿਨ ਰਾਤ ਆਉਣ ਆਣੀ ਜਾਣੀ ਕਰਕੇ ਉੱਥੇ ਕਾਫ਼ੀ ਕੂੜਾ ਕਰਕਟ ਵੀ ਹੁੰਦਾ ਹੈ ਅਤੇ ਮੈਂ ਆਪਣੇ ਇਲਾਕੇ ਨੂੰ ਇਸ ਤਰ੍ਹਾਂ ਸਾਫ਼ ਰੱਖਦੀ ਹਾਂ ਕਿ ਮੈਂ ਉੱਥੇ ਜੋ ਵੀ ਆਪਣੇ ਇਲਾਕੇ ਦੇ ਆਸ ਪਾਸ ਜਿੱਥੋਂ ਤੱਕ ਹੋ ਸਕੇ ਉੱਥੋਂ ਮੈਂ ਜੋ ਵੀ ਕੂੜਾ ਕਰਕਟ ਹੈ ਉਸਨੂੰ ਸਭ ਤੋਂ ਪਹਿਲਾਂ ਇਕੱਠਾ ਕਰਦੀ ਹਾਂ ਜੋ ਵੀ ਕੋਈ ਪਲਾਸਟਿਕ ਦੇ ਰੈਪਰ ਪ ਪਏ ਹਨ ਜਾਂ ਕੋਈ ਪਲਾਸਟਿਕ ਦੀ ਯੂਜ਼ ਕੀਤੀ ਹੋਈ ਚੀਜ਼ ਕੋਈ ਵੀ ਸੁੱਟੀ ਗਈ ਹੈ ਬੱਚਿਆਂ ਦੁਆਰਾ ਜਾਂ ਵੱਡਿਆਂ ਦੁਆਰਾ ਉਸਨੂੰ ਉੱਥੋਂ ਸਾਫ਼ ਕਰਦੀ ਹਾਂ ਉਸਨੂੰ ਉੱਥੋਂ ਉਠਾ ਕੇ ਡਸਟਬੀਨ ਵਿੱਚ ਰੱਖਦੀ ਹਾਂ ਅਤੇ ਜੋ ਵੀ ਆਪਣੇ ਇਲਾਕੇ ਦੇ ਆਸ ਪਾਸ ਹੈ ਰੋਜ਼ ਮੈਂ ਉੱਥੇ ਝਾੜੂ ਲਗਾਉਂਦੀ ਹਾਂ ਝਾੜੂ ਲਗਾ ਕੇ ਉੱਥੇ ਜਿੰਨਾ ਹੋ ਸਕੇ ਜ ਜਿੰਨਾਂ ਏਰੀਏ ਵਿੱਚ ਹੋ ਸਕੇ ਮੈਂ ਉਸ ਏਰੀਏ ਨੂੰ ਉਨਾਂ ਸਾਫ਼ ਰੱਖਦੀ ਹਾਂ ਜਿੱਥੋਂ ਤੱਕ ਹੋ ਸਕੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿੱਥੇ ਰਹਿੰਦੀ ਹਾਂ ਮੈਂ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸਾਫ਼ ਰੱਖਾਂ ਅਤੇ ਹੋਰ ਆਪਣੇ ਇਲਾਕੇ ਨੂੰ ਸਾਫ਼ ਰੱਖਣ ਲਈ ਮੈਂ ਇਹ ਵੀ ਪਰਿਆਸ ਕਰਦੀ ਹਾਂ ਕਿ ਜੋ ਮੇਰੇ ਘਰ ਦਾ ਕੂੜਾ ਕਟਕ ਹੈ ਕਰਕਟ ਹੈ ਜਾਂ ਗੰਦਗੀ ਹੈ ਮੈਂ ਉਸਨੂੰ ਸਿੱਧਾ ਹੀ ਗਲੀ ਵਿੱਚ ਜਾਂ ਸਿੱਧਾ ਨਾਲੀ ਵਿੱਚ ਨਾ ਸੁੱਟਾਂ ਤਾਂ ਕਿ ਜੋ ਇਲਾਕਾ ਮੇਰਾ ਸਾਫ਼ ਰਵੇ ਮੇਰੇ ਆਸ ਪਾਸ ਕੋਈ ਵੀ ਗੰਦਗੀ ਨਾ ਹੋਵੇ ਅਤੇ ਇਹ ਵੀ ਮੈਂ ਇੱਕ ਪਰਿਆਸ ਕਰਦੀ ਹਾਂ ਆਪਣੇ ਘਰ ਤੋਂ ਹੀ ਸ਼ੁਰੂ ਕਰਦੀ ਹਾਂ